ਸਿਲਾਈ ਕਢਾਈ ਤਾਂ ਹਰ ਇਕ ਔਰਤ ਦਾ ਅਤੇ ਕੁੜੀ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣਾ ਕੰਮ ਕਿਸੇ ਵੀ ਸਿਲਾਈ ਕਢਾਈ ਕਰ ਸਕੇ ਜਿੱਥੇ ਵੀ ਆਪਣਾ ਬੁਟੀਕ ਖੋਲ ਕੇ ਆਪਣੀ ਇਨਕਮ ਯਾਨੀ ਕਿ ਆਪਣੇ ਪਰਿਵਾਰ ਦਾ ਖਰਚਾ ਚਲਾ ਸਕੇ ਸਿਲਾਈ ਕਢਾਈ ਦੀ ਪਰ ਕਲਪਨਾ ਮੈਨੂੰ ਮੇਰੇ ਮੰਮੀ ਜੀ ਕੋਲੋਂ ਸਿੱਖੀ ਸੀ ਜੋ ਕਿ ਉਹ ਬਹੁਤ ਹੀ ਸੋਹਣਾ ਕੰਮ ਕਰਦੇ ਹਨ ਉਹਨਾਂ ਦਾ ਆਪਣਾ ਇੱਕ ਬੁਟੀਕ ਹੈ ਅਤੇ ਉਸ ਤੋਂ ਪਹਿਲਾਂ ਜਦੋਂ ਮੈਂ ਨਵੀਂ ਨਵੀਂ ਸਟੀਚਿੰਗ ਕੀਤੀ ਸਿੱਖਣੀ ਸ਼ੁਰੂ ਕੀਤੀ ਸੀ ਤਾਂ ਉਸ ਤੋਂ ਪਹਿਲਾਂ ਮੈਂ ਮੰਮੀ ਤੋਂ ਕਟਿੰਗ ਸਿੱਖੀ ਸੀ ਜੋ ਕਿ ਬਹੁਤ ਹੀ ਜ਼ਿਆਦਾ ਮੁਸ਼ਕਿਲ ਸੀ ਉਸ ਤੋਂ ਬਾਅਦ ਫਿਰ ਵੀ ਸਾਨੂੰ ਕਟਿੰਗ ਕਰਨ ਤੋਂ ਪਹਿਲਾਂ ਬਹੁਤ ਸਾਰੇ ਡਿਜਾਇਨ ਗਲੇ ਵਗੈਰਾ ਦੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਉਸ ਤੋਂ ਪਹਿਲਾਂ ਸਾਨੂੰ ਤਰਪਾਈ ਸਿਖਾਈ ਜਾਂਦੀ ਹੈ ਤਰਪਾਈ ਦੇ ਸਿਖਾਉਣ ਤੋਂ ਬਾਅਦ ਫਿਰ ਕਮੀਜ਼ ਤੋਂ ਤੋਪਾ ਕਿਵੇਂ ਲਗਾਇਆ ਜਾਂਦਾ ਉਹ ਸਿਖਾਇਆ ਜਾਂਦਾ ਹੈ ਮਸ਼ੀਨ 'ਚ ਧਾਗਾ ਕਿਵੇਂ ਪਾਇਆ ਜਾਂਦਾ ਉਸ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ ਇਹ ਸਾਰਿਆਂ ਕੁਝ ਸਿੱਖਣ ਲਈ ਮੇਰੇ ਆਪਣੀ ਮੰਮੀ ਜੀ ਤੋਂ ਬਹੁਤ ਮਿਹਨਤ ਨਾਲ ਕੰਮ ਸਿੱਖਿਆ ਸੀ ਸਿਲਾਈ ਕਢਾਈ ਦਾ ਕਿ ਉਹ ਮੈਨੂੰ ਇੱਕ ਵਧੀਆ ਹੋਣਹਾਰ ਵੀ ਕੋ ਬੱਚਾ ਬਣਾ ਸਕਣ ਜੋ ਕਿ ਆਪਣਾ ਅੱਗੇ ਜਾ ਕੇ ਉਹ ਸਿਲਾਈ ਕਢਾਈ ਦਾ ਕੰਮ ਕਰਨਾ ਸਿੱਖ ਸਕੇ ਅਤੇ ਆਪਣਾ ਇੱਕ ਬਟੀਕ ਖੋਲ ਸਕੇ